ਸਾਡੇ ਦੇਸ਼ ਵਿੱਚ ਕਈ ਲੋਕ ਕਲਾ ਅਤੇ ਸ਼ਿਲਪਕਾਰੀ ਜਾਂ ਹੁਨਰ ਅਧਿਕਾਰਿਤ ਕਿੱਤਿਆਂ ਜਿਵੇਂ ਕਿ ਮਿੱਟੀ ਦੇ ਭਾਂਡੇ ਤਰਖਾਣ ਆਦਿ ਵਿੱਚ ਲੱਗੇ ਹੋਏ ਆਦਿ ਵਿੱਚ ਲੱਗੇ ਹੋਏ ਹਨ ਸ਼ਿਲਪਕਾਰੀ ਅਤੇ ਸਿਰਜਨਾਤਮਕ ਗਤੀਵਿਧੀਆਂ ਬਹੁਤ ਸਾਰੇ ਲੋਕਾਂ ਦਾ ਸ਼ੌਂਕ ਬਣ ਗਿਆ ਹੈ ਜਿਨ੍ਹਾਂ ਵਿੱਚ ਆਮ ਤੌਰ 'ਤੇ ਆਪਣੇ ਹੱਥਾਂ ਨਾਲ਼ ਬਣਾਈਆਂ ਹੋਈਆਂ ਚੀਜ਼ਾਂ ਵੀ ਬਹੁਤ ਸ਼ਾਮਿਲ ਹੁੰਦੀਆਂ ਹਨ ਸ਼ੁਰੂ ਵਿੱਚ ਇਹ ਯੁੱਗ ਦੀ ਕਲਾ ਅਤੇ ਸ਼ਿਲਪਕਾਰੀ ਲਹਿਰ ਦੁਆਰਾ ਸਭ ਤੋਂ ਪਹਿਲਾਂ ਪ੍ਰਸਿੱਧ ਹੋਈਆਂ ਅਜਿਹੀਆਂ ਗਤੀਵਿਧੀਆਂ ਵਿੱਚ ਸਿਲਾਈ ਲੱਕੜ ਦਾ ਕੰਮ ਪੇਂਟਿੰਗ ਅਤੇ ਮੂਰਤੀ ਬਣਾਉਣ ਦੇ ਹੁਨਰ ਸ਼ਾਮਿਲ ਹਨ ਉੱਤਰ ਉੱਤਰ ਦਾਤਾਵਾਂ ਨੇ ਮਾਰਚ ਦੋ ਹਜ਼ਾਰ ਤੇਈ ਤੱਕ ਕਲਾ ਅਤੇ ਸ਼ਿਲਪਕਾਰੀ ਨੂੰ ਇੱਕ ਸ਼ੌਂਕ ਜਾਂ ਦਿਲਚਸਪੀ ਵਜੋਂ ਰਿਪੋਰਟ ਕੀਤਾ ਜਦੋਂ ਕਿ ਵੀਹ ਵੀਹ ਪ੍ਰਤੀਸ਼ਤ ਤੋਂ ਘੱਟ ਨੇ ਲਿਖਣ ਜਾਂ ਸੰਗੀਤ ਬਣਾਉਣ ਦਾ ਜ਼ਿਕਰ ਕੀਤਾ ਇਸ ਦੌਰਾਨ ਜਦੋਂ ਆਮਦਾਨੀ ਦੁਆਰਾ